ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਆਯੂਸ਼ਮਾਨ ਸਕੀਮ ਹੈ ਜਿਹੜੀ ਉਹ ਸਾਰਿਆਂ ਲਈ ਬੈਟਰ ਹੈ ਕਿਉਂਕਿ ਇਸਦੇ ਵਿੱਚ ਲੋਕ ਬਿਨਾਂ ਪੈਸੇ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ ਜਿਸਦੀ ਜੋ ਅਦਾਇਗੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਂਦੀ ਹੈ